ਪਾਣੀ ਪਾਣੀ ਇੱਕ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਇੱਕ ਵੱਡਮੁੱਲੀ ਦਾਤ ਹੈ ਅਤੇ ਇਹ ਕਿਸੇ ਵੀ ਵਕਤ ਸਾਡੀ ਧਰਤੀ ਤੋਂ ਮੁੱਕ ਸਕਦੀ ਹੈ ਜੇ ਅਸੀਂ ਇਸ ਦਾ ਫਿਜ਼ੂਲ ਵਰਤੋਂ ਕਰਾਂਗੇ ਪਾਣੀ ਸਾਨੂੰ ਬਹੁਤ ਤਰੀਕਿਆਂ ਲਈ ਚਾਹੀਦਾ ਹੁੰਦਾ ਜਿੱਦਾਂ ਪੀਣ ਲਈ ਸਾਨੂੰ ਪਾਣੀ ਚਾਹੀਦਾ ਹੁੰਦਾ ਪੌਦੇ ਲਗਾਉਣ ਲਈ ਸਾਨੂੰ ਪਾਣੀ ਚਾਹੀਦਾ ਹੁੰਦਾ ਹਰ ਕੰਮ ਪਾਣੀ ਨਾਲ ਹੀ ਹੁੰਦਾ ਸਾਡੇ ਕੱਪੜੇ ਪਾਣੀ ਨਾਲ ਧੋ ਹੁੰਦੇ ਹਨ ਸਾਡੀ ਰੋਟੀ ਵੀ ਪਾਣੀ ਨਾਲ ਬਣਦੀ ਹੈ ਪਾਣੀ ਨੂੰ ਅਸੀਂ ਜਿੰਨਾ ਬਚਾ ਕੇ ਰੱਖ ਸਖੀਏ ਉਨਾ ਬਚਾਅ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੀ ਅਗਲੀ ਪੀੜ੍ਹੀ ਲਈ ਸ਼ਾਇਦ ਇਹ ਨਾ ਬਚੇ ਜਿਸ ਤਰ੍ਹਾਂ ਇਸ ਦਾ ਦੁਰਉਪਯੋਗ ਹੋਣਡਿਆਂ ਪਾਣੀ ਨੂੰ ਕਈ ਲੋਕ ਇੱਦਾਂ ਹੀ ਵਾਟਰ ਸਪਲਾਈ ਦੀਆਂ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਹਨ ਜਿਸ ਕਰਕੇ ਉਹਦੀ ਕਿੰਨੀ ਵੇਸਟੇਜ਼ ਹੁੰਦੀ ਹੈ ਪਾਣੀ ਨੂੰ ਸਾਨੂੰ ਬਚਾਅ ਕੇ ਰੱਖਣਾ ਚਾਹੀਦਾ ਹੈ ਉਹਦਾ ਫਜ਼ੂਲ ਖਰਚ ਨਹੀਂ ਕਰਨਾ ਚਾਹੀਦਾ ਹੈ ਜਿਹੜੀ ਟੂਟੀ ਖੁੱਲ੍ਹੀ ਆ ਉਹਨੂੰ ਬੰਦ ਕਰੋ ਖੁੱਲ੍ਹੀ ਰੱਖਣ ਦਾ ਕੀ ਮਤਲਬ ਹੋਇਆ ਕਈਆਂ ਨੂੰ ਤਾਂ ਪੀਣਾ ਪਾਣੀ ਨਸੀਬ ਵੀ ਨਹੀਂ ਹੋ ਰਿਆ ਜਿਹੜੇ ਸੜਕਾਂ 'ਤੇ ਰੁਲਦੇ ਫਿਰਦੇ ਆ ਲੋਕ ਉਹਨਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਪਾਣੀ ਸਾਡੇ ਰੋਜ਼ਾਨਾ ਕਈ ਤਰ੍ਹਾਂ ਦੇ ਕੰਮਾਂ ਵਿੱਚ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਸੀਂ ਪੌਦੇ ਵਗੈਰਾ ਨਾਲ ਪਾਣੀ ਲਗਾਉਂਦੇ ਹਾਂ ਹੁਣ ਜਿੱਦਾ ਜੰਗਲ ਵੱਢੇ ਜਾਂਦੇ ਹਨ ਪੌਦੇ ਵੱਢਾਂਗੇ ਤਾਂ ਪਾਣੀ ਦੀ ਘਾਟ ਵੀ ਉਨੀ ਹੀ ਵੱਧਦੀ ਜਾਏਗੀ ਜੰਗਲ ਨਹੀਂ ਹੋਣਗੇ ਤਾਂ ਰੁੱਖ ਨਹੀਂ ਹੋਣਗੇ ਰੁੱਖ ਨਹੀਂ ਹੋਏਗਾ ਤਾਂ ਪਾਣੀ ਨਹੀਂ ਹੋਏਗਾ ਕਿਉਂਕਿ ਜਿਹੜਾ ਬਣਾਉਣ ਵਾਲੇ ਜੰਗਲ ਹੀ ਪਾਣੀ ਦੀ ਸਤਰ ਨੂੰ ਜ਼ਿਆਦਾ ਰੱਖਦੇ ਹਨ ਜਿੰਨੀ ਹਰਿਆਲੀ ਸਾਡੇ ਆਸੇ ਪਾਸੇ ਹੈਗੀ ਪਾਣੀ ਵੀ ਸਾਡੇ ਆਸੇ ਪਾਸੇ ਉਨਾ ਹੀ ਹੋਏਗਾ ਧਰਤੀ 'ਤੇ ਦੱਸਿਆ ਜਾਂਦਾ ਕਿ ਇਕਹੱਤਰ ਪਰਸੈਂਟ ਪਾਣੀ ਹੈ ਅਤੇ ਉਨੱਤੀ ਪਰਸੈਂਟ ਧਰਤੀ ਦਿਖੀ ਜਾਂਦੀ ਹੈ ਪਰ ਹੁਣ ਮੇਰੇ ਖਿਆਲ ਨਾਲ ਇਹ ਸੱਤਰ ਵੀ ਨਹੀਂ ਬਚਿਆ ਹੋਣਾ ਜਿਸ ਤਰ੍ਹਾਂ ਇਸ ਦਾ ਦੁਰਉਪਯੋਗ ਹੋਣਡਿਆਂ ਕਈ ਦੇਸ਼ਾਂ ਵਿੱਚ ਤਾਂ ਕਾਲ ਪੈ ਜਾਂਦੇ ਹਨ ਪਾਣੀ ਦੇ ਸਾਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ ਜੇ ਸਾਨੂੰ ਰੱਬ ਨੇ ਇਹ ਦਾਤ ਬਖਸ਼ੀ ਹੈ ਤਾਂ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਇਸ ਦੀ ਸਹੀ ਢੰਗ ਨਾਲ ਵਰਤੋਂ ਵੀ ਕਰਨੀ ਚਾਹੀਦੀ ਹੈ